ਸਾਡੇ ਖੇਤਰ ਵਿੱਚ ਹਰ ਧਰਮ ਦੇ ਲੋਕ ਰਹਿੰਦੇ ਹਨ ਪਰ ਮੈਂ ਜਿਹੜੀ ਆ ਹਿੰਦੂ ਧਰਮ ਤੋਂ ਬੀਲੌਂਗ ਕਰਦੀ ਹਾਂ ਅਤੇ ਸਾਡੇ ਘਰ ਦੇ ਵਿੱਚ ਧਾਰਮਿਕ ਛੁੱਟੀਆਂ 'ਤੇ ਜਿਵੇਂ ਕਿ ਹੁਣ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਸਾਵਣ ਦੇ ਮਹੀਨੇ ਦੇ ਵਿੱਚ ਆਪਾਂ ਸ਼ਿਵ ਜੀ ਦੀ ਪੂਜਾ ਕਰਦੇ ਹਨ ਉਹਨਾਂ ਨੂੰ ਜਿਹੜਾ ਹੈ ਸਵੇਰ ਨੂੰ ਚਾਰ ਵਜੇ ਉੱਠ ਕੇ ਜਿਹੜਾ ਹੈ ਉਹ ਜਲ ਚੜਾਉਂਦੇ ਹੈ ਉਹਨਾਂ ਨੂੰ ਕੱਚੀ ਲੱਸੀ ਦਾ ਜਿਹੜਾ ਅਭਿਸ਼ੇਕ ਕਰਵਾਉਂਦੇ ਹੈ ਹੋਰ ਲੋੋਕ ਜਿਹੜੇ ਹੈ ਸਾਵਣ ਦੇ ਮਹੀਨੇ ਦੇ ਵਿੱਚ ਵਰਤ ਰੱਖਦੇ ਹੈ ਸਾਵਣ ਦੇ ਮਹੀਨੇ ਦੇ ਵਿੱਚ ਖਾਸਕਰ ਜਿਹੜੇ ਹਿੰਦੂ ਧਰਮ ਤੋਂ ਨਾਲ ਜੁੜੇ ਹਨ ਉਹ ਜਿਹੜੇ ਹੈ ਕਾਵੜੀਏ ਹੁੰਦੇ ਹੈ ਉਹ ਗੰਗਾ ਜੀ ਲਿਆ ਕੇ ਜਿਹੜਾ ਹੈ ਉਹ ਸ਼ਿਵਜੀ ਜੀ ਦਾ ਇਸ਼ਨਾਨ ਕਰਵਾਉਂਦੇ ਹਨ